ਇਹ ਜਿਹੜੇ ਤਿੰਨ ਲੇਖਕਾਂ ਦੀ ਆਪਾਂ ਗੱਲ ਕਰ ਰਹੇ ਹਾਂ ਇਹਨਾਂ ਦਾ ਸਭ ਤੋਂ ਜ਼ਰੂਰੀ ਇਹਨਾਂ ਦੇ ਲੇਖਕ ਨਾਂ ਦੇ ਵਿੱਚੋਂ ਤੱਤ ਜਿਹੜਾ ਮੈਂ ਸਮਝਿਆ ਹੈ ਜਿਹੜਾ ਮੈਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਉਹ ਇਹਨਾਂ ਦੀ ਹੈ ਨਿਡਰਤਾ ਜਿਸ ਨਿਡਰਤਾ ਦੇ ਨਾਲ ਇਹ ਸਮਾਜਿਕ ਤੱਤਾਂ ਨੂੰ ਸਮਾਜ ਦੇ ਸਾਹਮਣੇ ਹੀ ਉਜਾਗਰ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਪ੍ਰੇਰਣਾਯੋਗ ਹੈ ਜਿਵੇਂ ਕਿ ਖਾਸ ਤੌਰ 'ਤੇ ਜਿਹੜਾ ਭੇਦਭਾਵ ਹੈ ਲਿੰਗ ਦੇ ਆਧਾਰ 'ਤੇ ਭੇਦਭਾਵ ਹੈ ਜਿਹੜਾ ਸਿੱਖਿਆ ਦੇ ਅਧਾਰ 'ਤੇ ਭੇਦਭਾਵ ਹੈ ਜਿਹੜਾ ਸਮਾਜਿਕ ਤਰੁਟੀਆਂ ਦੇ ਕਾਰਨ ਸਮਾਜ ਦੇ ਲੋਕਾਂ ਨੂੰ ਹੀ ਇੱਕ ਦੂਜੇ ਦੇ ਪ੍ਰਤੀ ਖੜੇ ਕਰ ਦੇਣਾ ਇਹ ਇਹ ਇਸ ਦੇ ਨਾਲ ਜਿਹੜਾ ਭੇਦਭਾਵ ਉਤਪੰਨ ਹੁੰਦਾ ਹੈ ਅਤੇ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਦੇ ਬੜੇ ਜਿਹੜੇ ਵਜ੍ਹਾ ਨੇ ਉਹ ਇਹਨਾਂ ਨੇ ਉਜਾਗਰ ਕੀਤੀਆਂ ਨੇ ਉਸ ਇਮੀਗ੍ਰੇਸ਼ਨ ਦੇ ਪਿੱਛੇ ਵੀ ਜਿਹੜੀ ਵਜ੍ਹਾ ਨੇ ਉਹ ਸਮਾਜਿਕ ਤੱਤਾਂ ਅਤੇ ਖਾਸ ਤੌਰ 'ਤੇ ਉਹਨਾਂ ਜਿਹੜੇ ਇਹ ਏਰੀਆਜ਼ ਨੇ ਉਹ ਜਿਹੜੇ ਪ ਪ੍ਰਾਂਤ ਨੇ ਉਹਨਾਂ ਪ੍ਰਾਂਤਾਂ ਦੇ ਵਿੱਚ ਲੋਕਾਂ ਨਾਲ ਹੋਣ ਵਾਲਾ ਭੇਦਭਾਵ ਚਾਹੇ ਉਹ ਲਿੰਗ ਦੇ ਆਧਾਰ 'ਤੇ ਹੋਵੇ ਚਾਹੇ ਸਿੱਖਿਆ ਦੇ ਮਿਆਰ ਦੇ ਆਧਾਰ 'ਤੇ ਹੋਵੇ ਚਾਹੇ ਉਸ ਜੀਵ ਦੀ ਸਮਾਜਿਕ ਤੁਸ਼ਟੀਕਰਨ ਦੇ ਅਧਾਰ 'ਤੇ ਹੋਵੇ ਇਹਨਾਂ ਸਾਰਿਆਂ ਚੀਜ਼ਾਂ ਨੂੰ ਜਦੋਂ ਉਜਾਗਰ ਕਰਦੇ ਨੇ ਇਹ ਸਾਰੀਆਂ ਚੀਜ਼ਾਂ ਮੈਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ ਅਤੇ ਪ੍ਰੇਰਨਾ ਦਿੰਦੀਆਂ ਨੇ ਧੰਨਵਾਦ